ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ

ਅੱਛਾ ਹਾਂਜੀ ਤੁਹਾਡਾ ਨਾਮ ਕਿੱਥੋਂ ਬੋਲਦੇ ਹੋ ਤੁਸੀਂ ਅੱਛਾ ਕੀ ਕੁਆਲੀਫਿਕੇਸ਼ਨ ਹੈ ਤੁਹਾਡੀ ਅੱਛਾ ਓਕੇ ਅੱਛਾ ਅੱਛਾ ਕਿਹੜੀ ਕਲਾਸਿਸ ਨੂੰ ਪੜ੍ਹਾਉਣਾ ਪ੍ਰੈਫਰ ਕਰੋਂਗੇ ਤੁਸੀਂ ਅੱਛਾ ਓਕੇ ਅਤੇ ਸੈਲਰੀ ਤੁਹਾਡਾ ਕਿੰਨਾ ਸੈਲਰੀ ਤੁਸੀਂ ਅੱਛਾ ਓਕੇ ਅਤੇ ਤੁਸੀਂ ਇੰਟਰਵਿਊ ਲਈ ਆ ਸਕਦੇ ਹੋ ਮੰਡੇ ਨੌ ਤੋਂ ਬਾਰਾਂ ਦੇ ਵਿੱਚ ਵਿੱਚ

ਟਾਈਮਿੰਗ ਆਪਣੀ ਸਵੇਰੇ ਨੌ ਤੋਂ ਸ਼ਾਮੀ ਤਿੰਨ ਵਜੇ ਤੱਕ ਤੁਸੀਂ ਫੁਲ ਟਾਈਮ ਜਾਂ ਤੁਸੀਂ ਆ ਅੱਛਾ ਓਕੇ ਪਹਿਲਾਂ ਤੁਹਾਡਾ ਕੋਈ ਐਕਸਪੀਰੀਐਂਸ ਹੈਗਾ ਟੀਚਿੰਗ ਦਾ ਜਾਂ ਅੱਛਾ ਓਕੇ ਓਕੇ ਓਕੇ ਅਤੇ ਤੁਸੀਂ ਆਪਣੇ ਸਾਰੇ ਡੋਕੂਮੈਂਟਸ ਵਗੈਰਾ ਲੈ ਕੇ ਮੰਡੇ ਨੂੰ ਆਜਿਓ ਇੰਟਰਵਿਊ ਲਈ ਉਸ ਤੋਂ ਬਾਅਦ ਤੁਹਾਡਾ ਪੇਅ ਸੈਲਰੀ ਸਕੇਲ ਤੁਹਾਨੂੰ ਦੱਸ ਦਿੱਤਾ ਜਾਵੇਗਾ ਹਾਂਜੀ ਹਾਂਜੀ ਆੱਫਿਸ 'ਤੇ ਮਿਲਣਾ